ਇੱਕ ਸੌ ਛਪੰਜ੍ਹਾ ਨੌਂ ਹਜ਼ਾਰ ਪੰਜ ਸੌ ਚੌਂਤੀ ਪੰਝੱਤਰ ਹਜ਼ਾਰ ਤਿੰਨ ਸੌ ਦਸ ਇੱਕ ਲੱਖ ਛਿਆਸੀ ਹਜ਼ਾਰ ਨੌਂ ਸੌ ਉੱਨੀ ਨੌਂ ਲੱਖ ਪਚਾਨਵੇਂ ਹਜ਼ਾਰ ਛੇ ਸੌ ਪਚਵਿੰਜਾ